ਮੇਰੇ ਸਕੂਲ ਵਿੱਚ ਸਮਾਗਮ ਅਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਮੁਕਾਬਲੇ ਸਨ ਜਿਵੇਂ ਕਿ ਪੇਂਟਿੰਗ ਰਾਈਟਿੰਗ ਡਾਂਸਿੰਗ ਇਸ ਲਈ ਮੈਂ ਇਸ ਮੁਕਾਬਲੇ ਵਿੱਚ ਪੇਂਟਿੰਗ ਦੇ ਵਿੱਚ ਹਿੱਸਾ ਲਿਆ ਜਿਸ ਦੇ ਕਾਰਨ ਮੈਂ ਇੱਕ ਪੇਂਟਿੰਗ ਬਣਾਈ ਉਹ ਪੇਂਟਿੰਗ ਮੇਰੇ ਅਧਿਆਪਕਾਂ ਅਤੇ ਮੇਰੇ ਸਾਥੀ ਵਿਦਿਆਰਥੀਆਂ ਨੂੰ ਬਹੁਤ ਹੀ ਪਸੰਦ ਆਈ ਜਿਸ ਕਾਰਨ ਮੇਰੇ ਅਧਿਆਪਕਾਂ ਨੇ ਮੈਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਤੂੰ ਬਹੁਤ ਅੱਛੀ ਪੇਂਟਿੰਗ ਕਰ ਲੈਂਦਾ ਹੈ ਤੈਨੂੰ ਇਸ ਪੇਂਟਿੰਗ ਵਿੱਚ ਦਿਲਚਸਪੀ ਦੇਣੀ ਚਾਹੀਦੀ ਹੈ ਤਾਂ ਜੋ ਤੂੰ ਇਸ ਪੇਂਟਿੰਗ ਦੌਰਾਨ ਅੱਗੇ ਕਿਤੇ ਪਹੁੰਚ ਸਕੇ ਤਾਂ ਹੀ ਮੈਂ ਪੇਂਟਿੰਗ ਵਿੱਚ ਦਿਲਸਚਪ ਦਿਲਚਸਪੀ ਲੈਣਾ ਪਸੰਦ ਕਰਦਾ ਹਾਂ